ਪੰਜਾਬ ਵਿੱਚ ਅੰਗਰੇਜ਼ਾਂ ਦੁਆਰਾ ਅੰਗਰੇਜ਼ਾਂ ਦੁਆਰਾ ਰੇਲਵੇ ਨਿਰਵਾਨ ਬਹੁਤ ਹੀ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਨਹੀਂ ਸੀ ਕਿਉਂਕਿ ਹਾਂ ਪੁਰਾਣੇ ਸਮੇਂ ਵਿੱਚ ਰੇਲਵੇ ਅੰਗਰੇਜ਼ਾਂ ਨੂੰ ਹਾਂ ਤੁਰ ਕੇ ਤੁਰ ਕੇ ਜਾਣਾ ਪੈਂਦਾ ਸੀ ਅਤੇ ਉਹਨਾਂ ਨੂੰ ਹਾਂ ਟਿਕਟ ਵੀ ਉੱਥੇ ਜਾ ਕੇ ਹੀ ਲੈਂਦੇ ਉਹਨਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਕਿਉਂਕਿ ਕਿਉਂਕਿ ਅੱਜ ਕੱਲ੍ਹ ਸ਼ਹਿਰੀ ਸ਼ਹਿਰੀਕਰਨ ਵਿੱਚ ਹਾਂ ਅਸੀਂ ਆਨਲਾਈਨ ਬੁਕਿੰਗ ਕਰ ਸਕਦੇ ਹਾਂ ਫੋਨਾਂ 'ਤੇ ਕੰਪਿਊਟਰਾਂ 'ਤੇ ਹਾਂ ਅਸੀਂ ਘਰ ਬੈਠੇ ਹੀ ਕਰਨ ਕਿਉਂਕਿ ਸਾਨੂੰ ਪਰੇਸ਼ਾਨੀ ਦਾ ਉਹ ਨਹੀਂ ਕਰ ਸਾਹਮਣਾ ਨਹੀਂ ਕਰਨਾ ਪੈਂਦਾ ਅਤੇ ਗਤੀਸ਼ੀਲਤਾ ਬਹੁਤ ਹੀ ਵੱਧ ਚੁੱਕੀ ਹੈ ਅਤੇ ਇਸ ਇਸ ਵਿੱਚ ਅਸੀਂ ਹਾਂ ਅਤੇ ਕੋਈ ਵੀ ਸਾਨੂੰ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਅਸੀਂ ਕਦੋਂ ਵੀ ਮਰਜ਼ੀ ਹਾਂ ਆਨਲਾਈਨ ਕਰ ਸਕਦੇ ਹਾਂ ਬੁੱਕ ਬੁੱਕ ਟਿਕ ਟਿਕਟ ਅਤੇ ਆਪਦੀ ਹੀ ਸੀਟ ਬੁਕਿੰਗ ਵੀ ਕਰ ਸਕਦੇ ਹਾਂ ਉਹਦੇ ਵਿੱਚ ਪਹਿਲਾਂ ਦੇ ਸਮਾਂ ਵਿੱਚੋਂ ਹਾਂ ਸੀਟ ਬੁਕਿੰਗ ਨਹੀਂ ਕਰਨੀ ਪੈਂਦੀ ਕਰਨੀ ਪੈਂਦੀ ਸੀ ਅਤੇ ਉਹਨਾਂ ਨੂੰ ਧੱਕੇ ਧੋਕੇ ਨਾਲ ਚਾੜਨਾ ਪੈਂਦਾ ਸੀ ਅਤੇ ਅੱਜ ਕੱਲ੍ਹ ਦੇ ਲੋਕ ਸ਼ਹਿਰੀਕਰਨ ਬਹੁਤ ਹੀ ਅੱਗੇ ਜਾ ਚੁੱਕਿਆ ਹੈ ਅੱਜ ਦਾ ਯੁੱਗ ਬਹੁਤ ਹੀ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ